ਹਾਂਜੀ ਮੈਂ ਦੱਸਣਾ ਚਾਹੁੰਦਾ ਹਾਂ ਕਿ ਮੇਰੀ ਸਿਹਤ ਕਾਫੀ ਦਿਨਾਂ ਤੋਂ ਕਮਜ਼ੋਰ ਮਹਿਸੂਸ ਕਰ ਰਿਹਾ ਹਾਂ ਮੈਨੂੰ ਸ਼ਾਇਦ ਬੁਖਾਰ ਜਾਂ ਟਾਈਫੈਡ ਖਾਂਸੀ ਵਗੈਰਾ ਹੈ ਇਸ ਲਈ ਮੈਂ ਆਪਣਾ ਨੇੜੇ ਦੇ ਕਲੀਨਿਕ ਲੱਭਣ ਲਈ ਗੂਗਲ ਮੈਪ ਉਤੇ ਸਰਚ ਕਰ ਰਿਹਾ ਹਾਂ ਕੁਝ ਕਲੀਨਿਕਸ ਮੈਨੂੰ ਨਜ਼ਰ ਆਉਣ ਦੀ ਉਮੀਦ ਹੈ ਜਿਹੜੇ ਕਿ ਮੇਰੇ ਘਰ ਦੇ ਨੇੜੇ ਹਨ ਅਤੇ ਦੋ ਸੌ ਮੀਟਰ ਦੇ ਘੇਰੇ ਵਿੱਚ ਪੈਂਦੇ ਹਨ ਮੈਂ ਇਹਨਾਂ ਕਲੀਨਿਕਾਂ ਉਤੇ ਜਾ ਕੇ ਆਪਣਾ ਚੈੱਕਅਪ ਕਰਾਵਾਂਗਾ ਖੂਨ ਦੇ ਟੈਸਟ ਕਰਵਾਵਾਂਗਾ ਜਿਸ ਨਾਲ ਮੇਰੀ ਬਿਮਾਰੀ ਦਾ ਪਤਾ ਲੱਗ ਸਕੇ ਮੈਂ ਕਾਫੀ ਦਿਨਾਂ ਤੋਂ ਕਮਜ਼ੋਰ ਫੀਲ ਕਰ ਰਿਹਾ ਹਾਂ ਮੇਰੇ ਸਰੀਰ ਵਿੱਚ ਜਾਨ ਬਹੁਤ ਘੱਟ ਰਹਿ ਗਈ ਹੈ ਮੈਨੂੰ ਤੇਜ਼ ਬੁਖਾਰ ਹੁੰਦਾ ਹੈ ਅਤੇ ਮੈਂ ਇਹ ਕਲੀਨਿਕਾਂ ਵਿੱਚ ਜਾ ਕੇ ਆਪਣਾ ਇਲਾਜ ਕਰਵਾਵਾਂਗਾ ਮੈਂ ਦੱਸਣਾ ਚਾਹੁੰਦਾ ਕਿ ਹੰਡਿਆਇਆ ਪਿੰਡ ਦੇ ਵਿੱਚ ਇੱਕ ਕਲੀਨਿਕ ਹੈ ਜਿਸ ਨੂੰ ਮੁਹੱਲਾ ਕਲੀਨਿਕ ਕਹਿੰਦੇ ਹਨ ਉਹ ਮੇਰੇ ਘਰ ਤੋਂ ਤਿੰਨ ਸੌ ਮੀਟਰ ਦੀ ਦੂਰੀ 'ਤੇ ਹੈ ਮੈਂ ਗੂਗਲ ਮੈਪ ਉੱਤੇ ਦੇਖਿਆ ਹੈ ਅਤੇ ਉਹ ਮੈਨੂੰ ਲੱਭ ਗਿਆ ਹੈ ਕੱਲ੍ਹ ਨੂੰ ਮੈਂ ਉੱਥੇ ਜਾ ਕੇ ਆਪਣੇ ਖੂਨ ਦੇ ਟੈਸਟ ਦੇਵਾਂਗਾ ਜਿਹੜੇ ਕਿ ਫ੍ਰੀ ਹੁੰਦੇ ਹਨ ਅਤੇ ਮੈਂ ਆਪਣਿਆਂ ਸਾਰਾ ਬੋਡੀ ਦਾ ਚੈੱਕਅਪ ਕਰਵਾਵਾਂਗਾ ਜਿਸ ਨਾਲ ਮੇਰਾ ਪਤਾ ਲੱਗ ਸਕੇ ਵੀ ਮੇਰੀ ਬਾਡੀ ਵਿੱਚ ਕਿਸ ਬਿਮਾਰੀ ਕਾਰਨ ਮੈਨੂੰ ਕਮਜ਼ੋਰੀ ਫੀਲ ਹੋ ਰਹੀ ਹੈ ਅਤੇ ਮੇਰਾ ਬਲੱਡ ਬਹੁਤ ਘੱਟ ਰਿਹਾ ਹੈ ਮੈਂ ਉੱਥੇ ਜਾ ਕੇ ਗੁਲੂਕੋਜ਼ ਦੀਆਂ ਬੋਤਲਾਂ ਵੀ ਲਗਾਵਾਂਗਾ ਮੈਂ ਦੱਸਣਾ ਚਾਹੁੰਦਾ ਹਾਂ ਕਿ ਪਹਿਲਾਂ ਮੇਰੀ ਜਿਹੜੀ ਦਵਾਈ ਸੀ ਉਹ ਬਰਨਾਲਾ ਸ਼ਹਿਰ ਤੋਂ ਚੱਲਦੀ ਸੀ ਜੋ ਕਿ ਮੈਂ ਬੰਦ ਕਰ ਦਿੱਤੀ ਹੈ ਹੁਣ ਮੈਂ ਗੂਗਲ ਮੈਪ ਉਤੇ ਖੋਲ੍ਹ ਕੇ ਵੇਖਿਆ ਹੈ ਮੇਰੇ ਨੇੜੇ ਕਲੀਨਿਕ ਮੁਹੱਲਾ ਕਲੀਨਿਕ ਹੈ ਜੋ ਕਿ ਗਰੀਬਾਂ ਦੀ ਸਹਾਇਤਾ ਲਈ ਬਣਾਏ ਗਏ ਹਨ ਅਤੇ ਮੈਂ ਉੱਥੇ ਜਾ ਕੇ ਦਵਾਈ ਲਵਾਂਗਾ ਇਹ ਮੁਹੱਲਾ ਕਲੀਨਿਕ ਸਾਡੇ ਪਿੰਡ ਵਿੱਚ ਬਹੁਤ ਮਸ਼ਹੂਰ ਹੈ ਇਹ ਸਰਕਾਰ ਦੁਆਰਾ ਖੋਲ੍ਹਿਆ ਗਿਆ ਹੈ ਇੱਥੇ ਬਹੁਤ ਸਾਰੇ ਲੋਕ ਹਿੱਸਾ ਲੈਂਦੇ ਹਨ ਆਪਣੇ ਇਲਾਜ ਕਰਵਾਉਂਦੇ ਹਨ ਅਤੇ ਆਪਣੇ ਟੈਸਟ ਕਰਵਾਉਂਦੇ ਹਨ ਮੈਂ ਵੀ ਇੱਥੇ ਜਾਵਾਂਗਾ ਅਤੇ ਆਪਣਾ ਟੈਸਟ ਕਰਵਾਵਾਂਗਾ ਅਤੇ ਇਲਾਜ ਕਰਵਾਵਾਂਗਾ ਧੰਨਵਾਦ